ਅਤੇ ਇਹ ਪ੍ਰਸ਼ਨ ਕੁਛ ਇਸ ਪ੍ਰਕਾਰ ਹੈ ਤੁਹਾਡੇ ਦੁਆਰਾ ਬਣਾਈ ਗਈ ਸਭ ਤੋਂ ਚੁਣੌਤੀਪੂਰਨ ਅ ਚਿੱਤਰਕਾਰੀ ਕਿਹੜੀ ਹੈ ਅਤੇ ਤੁਸੀਂ ਅਨੁਭਵ ਤੋਂ ਕੀ ਸਿੱਖਿਆ ਮੈਂ ਜਿੰਨਾ ਮੈਨੂੰ ਯਾਦ ਆ ਰਿਹਾ ਕਿ ਸਭ ਤੋਂ ਚੁਣੌਤੀਪੂਰਨ ਮੇਰੀ ਚਿੱਤਰਕਾਰੀ ਸੀਗੀ ਈ ਜੀ ਡੀ ਦੀ ਮਤਲਬ ਈ ਜੀ ਡੀ ਨਹੀਂ ਕਹਿ ਸਕਦੇ ਉਹਨੂੰ ਮਤਲਬ ਮੈਂ ਇੱਕ ਡਰਾਇੰਗ ਬਣਾਈ ਸੀਗੀ ਆਪਣੇ ਖੁਦ ਦੀ ਬਣਾਈ ਸੀ ਮਤਲਬ ਬਹੁਤ ਮੈਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਉਸ ਦਿਨ ਮੈਨੂੰ ਉਸ ਚੀਜ਼ ਤੋਂ ਪਤਾ ਚੱਲਿਆ ਕਿ ਮਤਲਬ ਚਿੱਤਰਕਾਰੀ ਨਾ ਆਸਾਨੀ ਚੀਜ਼ ਨਹੀਂ ਹੈ ਜਿਵੇਂ ਤੁਸੀਂ ਚਿੱਤਰਕਾਰੀ ਕਰਦੇ ਹੋ ਤਾਂ ਇਕੱਲਾ ਇਹ ਨਹੀਂ ਹੈ ਕਿ ਆਪਾਂ ਸਾਹਮਣੇ ਦੇਖ ਲਿਆ ਅਤੇ ਉਹਨੂੰ ਬਣਾ ਲਿਆ ਇੰਨਾ ਸੌਖਾ ਨਹੀਂ ਹੁੰਦਾ ਉਹਨੂੰ ਬਣਾਉਣ ਲਈ ਬਹੁਤ ਦਿਮਾਗ ਬਹੁਤ ਕਲਾ ਦਾ ਬਹੁਤ ਮਤਲਬ ਇਸਤੇਮਾਲ ਹੁੰਦਾ ਵਾ ਤੇ ਅਤੇ ਇਹਦੇ ਵਾਸਤੇ ਨਾ ਅਲੱਗ ਅਲੱਗ ਪੈਂਸਿਲਸ ਵੀ ਆਉਂਦੀ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਅਲੱਗ ਅਲੱਗ ਸੇਡਿੰਗ ਕਰਨੀ ਹੈ ਸਾਨੂੰ ਜੇ ਕੁਛ ਹੋਰ ਕਰਨਾ ਨਾ ਤਾਂ ਉਹਦੇ ਵਾਸਤੇ ਅਲੱਗ ਅਲੱਗ ਪੈਂਸਿਲ ਆਉਂਦੀ ਹੈ ਆਪਾਂ ਉਸ ਰਾਹੀਂ ਉਹਨੂੰ ਕਰ ਸਕਦੇ ਹਾਂ ਸ਼ੇਡ ਵਗੈਰਾ ਜਿਵੇਂ ਮੋਟੀ ਆ ਉਹਦਾ ਜੇ ਆਪਾਂ ਬਾਉਂਡਰੀ ਲਾਈਨ ਬਣਾਉਣੀ ਹੁੰਦੀ ਹੈ ਅਤੇ ਉਹਨੂੰ ਮੋਟੀ ਪੈਂਸਿਲ ਨਾਲ ਕਰਨਾ ਹੁੰਦਾ ਜੇ ਆਪਾਂ ਉਹਨਾਂ ਨੂੰ ਥੋੜ੍ਹਾ ਲਾਈਟ ਕਰਨਾ ਹੁੰਦਾ ਥੋੜ੍ਹੀ ਪਤਲੀ ਪੈਂਸਿਲ ਨਾਲ ਉਹਨਾਂ ਸ਼ੇਡ ਵਗੈਰਾ ਹੁੰਦਾ ਵਾ ਅਤੇ ਮਤਲਬ ਚਿੱਤਰਕਾਰੀ ਮੈਂ ਆਪਣੀ ਬਣਾਈ ਸੀਗੀ ਮਤਲਬ ਮੈਂ ਕਾਫ਼ੀ ਵਾਰ ਉਹਨੂੰ ਕੋਸ਼ਿਸ਼ ਕੀਤੀ ਮਤਲਬ ਇੱਕ ਵਾਰ ਕੀਤਾ ਨਹੀਂ ਹੋਇਆ ਵਧੀਆ ਨਹੀਂ ਹੋਇਆ ਦੂਜੀ ਵਾਰ ਕੀਤਾ ਉਹ ਵੀ ਮਤਲਬ ਠੀਕ ਨਹੀਂ ਹੋਇਆ ਸੀ ਤੀਜੀ ਵਾਰ ਕੀਤਾ ਉਹ ਵੀ ਨਹੀਂ ਇੰਨਾਂ ਵਧੀਆ ਬਣਿਆ ਮਤਲਬ ਲਗਭਗ ਮੈਂ ਕਹਿ ਸਕਦਾ ਪੰਦਰਾਂ ਵੀਹ ਵਾਰ ਕੋਸ਼ਿਸ਼ ਕੀਤੀ ਸੀਗੀ ਉਸ ਤੋਂ ਬਾਅਦ ਕਿੱਥੇ ਜਾ ਕੇ ਮੈਨੂੰ ਲੱਗਿਆ ਹਾਂ ਇਹ ਮੇਰੀ ਹੀ ਸ਼ਕਲ ਹੈ ਮਤਲਬ ਬਹੁਤ ਮਿਹਨਤ ਲੱਗੀ ਸੀ ਮੈਨੂੰ ਉਸ ਚੀਜ਼ ਨੂੰ ਬਣਾਉਣ ਅਤੇ ਮੈਂ ਉਸ ਚੀਜ਼ ਤੋਂ ਇਹ ਸਿੱਖਿਆ ਨਾ ਕਿ ਆਪਾਂ ਕਿਸ ਚੀਜ਼ ਨੂੰ ਜੇ ਸ਼ਿੱਦਤ ਅਗਰ ਹਮ ਕਿਸੀ ਚੀਜ ਕੋ ਸ਼ਿੱਦਤ ਸੇ ਚਾਹ ਲੇ ਤੋ ਪੂਰੀ ਕਾਇ ਤਾਂ ਕਾਇਨਾਤ ਸਾਨੂੰ ਉਸ ਤੋਂ ਮਿਲਾਉਣ ਦੀ ਜ਼ਰੂਰਤ ਕਰ ਦਿੰਦੀ ਹੈ ਅਤੇ ਆਹ ਉਹ ਹੀ ਹੋ ਗਏ ਸਾਡੇ ਬੋਲੀਵੁੱਡ ਦੀ ਸ ਬਹੁਤ ਵੱਡੇ ਕਲਾਕਾਰ ਸ਼ਾਹਰੁਖ ਖਾਨ ਜੀ ਨੇ ਗੱਲ ਦੱਸੀ ਸੀਗੀ ਕਿ ਕਿਸੀ ਚੀਜ਼ ਕੋ ਅਗਰ ਸ਼ਿੱਦਤ ਸੇ ਪਾਨੇ ਕੀ ਕੋਸ਼ਿਸ਼ ਕਰੇ ਤੋ ਪੂਰੀ ਕਾਇਨਾਤ ਸਾਨੂੰ ਉਸਕੋ ਮਿਲਾਨੇ ਮੇ ਮਿਲ ਜਾਤੀ ਹੈ ਅਤੇ ਮਤਲਬ ਇਹ ਡਾਇਲੋਗ ਹਿੰਦੀ 'ਚ ਸੀਗਾ ਲੇਕਿਨ ਮੈਨੂੰ ਕਨਵਰਟ ਕਰਕੇ ਤੁਹਾਨੂੰ ਦੱਸਿਆ ਵਾ ਤੁਸੀਂ ਸਮਝ ਸਕਦੇ ਹੋ ਉਸ ਚੀਜ਼ ਨੂੰ ਮਤਲਬ ਕਾਫ਼ੀ ਮਿਹਨਤ ਲੱਗੀ ਸੀ ਮੈਨੂੰ ਉਸ ਚੀਜ਼ ਨੂੰ ਬਣਾਉਣ ਅਤੇ ਮੈਂ ਉਸ ਚੀਜ਼ ਤੋਂ ਸਿੱਖਿਆ ਸੀਗਾ ਕਿ ਹਾਂ ਸਬਰ ਕਾ ਫਲ ਮੀਠਾ ਹੋਤਾ ਹੈ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਆਪਾਂ ਹਰ ਇੱਕ ਮੁਕਾਮ ਨੂੰ ਹਰ ਇੱਕ ਮੰਜ਼ਿਲ ਨੂੰ ਹਰ ਇੱਕ ਰਾਹ ਨੂੰ ਹਰ ਇੱਕ ਚੀਜ਼ ਨੂੰ ਫਤਿਹ ਕਰ ਸਕਦੇ ਹਾਂ ਅਤੇ ਬਹੁਤ ਮਿਹਨਤ ਲਗਨ ਨਿਸ਼ਠਾ ਅਤੇ ਪ੍ਰੇਮ ਨਾਲ ਮੈਂ ਆਪਣਾ ਚਿੱਤਰ ਬਣਾਇਆ ਅਤੇ ਮੈਂ ਆਪਣੇ ਘਰ ਦਿਆਂ ਨੂੰ ਵੀ ਉਹ ਚਿੱਤਰ ਦਿਖਾਇਆ ਸੀਗਾ ਉਹ ਕਹਿੰਦੇ ਤੇਰਾ ਚਿੱਤਰ ਬਹੁਤ ਸੋਹਣਾ ਬਹੁਤ ਮਿਹਨਤ ਮਤਲਬ ਕਾਫ਼ੀ ਮਤਲਬ ਪੰਦਰਾਂ ਵੀਹ ਅਟੈਮਪਟ ਤੋਂ ਬਾਅਦ ਉਹ ਚਿੱਤਰ ਬਣਿਆ ਸੀਗਾ ਮਤਲਬ ਮੈਨੂੰ ਪਤਾ ਲੱਗਿਆ ਕਿ ਹਾਂ ਆਸਾਨ ਨਹੀਂ ਹੁੰਦਾ ਕੁਛ ਵੀ ਕਰ ਪਰ ਨਾਮੁਮਕਿਨ ਵੀ ਨਹੀਂ ਹੁੰਦਾ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਜੇ ਆਪਾਂ ਕਰਾਂਗੇ ਹੋ ਜੂਗਾ ਅਤੇ ਬਸ ਮੈਂ ਤੁਹਾਨੂੰ ਇਸ ਚੀਜ਼ ਬਾਰੇ ਇਹ ਹੀ ਦੱਸਣਾ ਚਾਹੁੰਦਾ ਅਤੇ ਮੈਨੂੰ ਉਮੀਦ ਹੈ ਤੁਹਾਨੂੰ ਇਸ ਚੀਜ਼ ਤੋਂ ਕੁਛ ਸਿੱਖਣ ਨੂੰ ਮਿਲਿਆ ਹੋਊਗਾ ਜਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਅਤੇ ਬਸ ਮੈਂ ਇਹ ਹੀ ਕਹਿਣਾ ਚਾਹੁੰਦਾ ਸੀਗਾ ਅਤੇ ਮੈਂ ਕਹਿ ਚੁੱਕਿਆ ਹਾਂ ਅਤੇ ਮੈਂ ਤੁਹਾਨੂੰ ਊ ਧੰਨਵਾਦ ਕਹਿੰਦਾ ਹਾਂ